ਸਾਡੇ ਧਰਮ ਦਾ ਨਾਮ ਹੈ ਜੀ ਸਿੱਖ ਧਰਮ ਇਸ ਧ ਧਰਮ ਨਾਲ ਕਈ ਇਤਿਹਾਸਿਕ ਘਟਨਾਵਾਂ ਜੁੜੀਆਂ ਹਨ ਜਿਹਨਾਂ ਵਿੱਚੋਂ ਇੱਕ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਚਾਰ ਸਾਹਿਬਜ਼ਾਦੇ ਸਨ ਉਹਨਾਂ ਨੇ ਆਪਣੇ ਧਰਮ ਦੇ ਲਈ ਆਪਣੀਆਂ ਕੁਰਬਾਨੀਆਂ ਕੀਤੀਆਂ ਦਿੱਤੀਆਂ ਕਿਉਂਕਿ ਜਿਹੜੇ ਮੁਗਲ ਸੀ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਮੁਸਲ ਮੁਸਲਮਾਨ ਬਣਨ ਲਈ ਮਜਬੂਰ ਕਰ ਰਹੇ ਸੀ ਕਿ ਉਹ ਜਿਹੜਾ ਆਪਣਾ ਸਿੱਖ ਧਰਮ ਛੱਡ ਕੇ ਅਤੇ ਉਹ ਜਿਹੜਾ ਮੁਸਲਿਮ ਮੁਸਲਿਮ ਧਰਮ ਜਿਹੜਾ ਹੈਗਾ ਉਹ ਅਪਣਾ ਲੈਣ ਪਰ ਉਹਨਾਂ ਨੇ ਆਪਣਾ ਧਰਮ ਨਾ ਛੱਡਣ ਦਾ ਫੈਸਲਾ ਲਿਆ ਅਤੇ ਇਸ ਜਿਸ ਕਰਕੇ ਦੋ ਜਿਹੜੇ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸੀ ਮੁਗਲਾਂ ਨੇ ਉਹਨਾਂ ਨੂੰ ਇੱਟਾਂ ਦੇ ਵਿੱਚ ਚਿਣਵਾ ਦਿੱਤਾ ਅਤੇ ਉਹ ਉੱਥੇ ਹੀ ਉਹਨਾਂ ਦੀ ਸਾਹ ਖਤਮ ਹੋ ਗਏ ਅਤੇ ਜਿਹੜੇ ਦੋ ਸ਼ੈਹ ਸਾਹਿਬਜ਼ਾਦੇ ਸੀਗੇ ਉਹ ਜਿਹੜੇ ਸੀਗੇ ਉਹ ਜੰਗ ਵਿੱਚ ਸ਼ਹੀਦ ਹੋ ਗਏ ਇਸ ਕਰਕੇ ਜਿਹੜਾ ਇਹ ਲੜਾਈ ਜਿਹੜੀ ਹੈਗੀ ਜਿਹਨੂੰ ਅਨੰਦਪੁਰ ਸਾਹਿਬ ਕਿਲ੍ਹੇ ਦੀ ਲੜਾਈ ਜਿਹੜੀ ਕਹੀ ਜਾਂਦੀ ਹੈ ਇਹ ਬਹੁਤ ਹੀ ਜ਼ਿਆਦਾ ਇਤਿਹਾਸਿਕ ਹੈ